ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਾਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਪਹਿਲਾਂ ਤਾਂ ਸਾਨੂੰ ਪ੍ਰੋਪਰ ਸਾਰਾ ਕਾਰੋਬਾਰ ਬਾਰੇ ਜਿਹੜਾ ਅਸੀਂ ਸਟਾਰਟ ਕਰਨਾ ਸ਼ੁਰੂ ਕਰਨਾ ਅਤੇ ਉਹਦਾ ਧਿਆਨ ਹੋਣਾ ਚਾਹੀਦਾ ਉਹਦਾ ਪਤਾ ਹੋਣਾ ਚਾਹੀਦਾ ਕਿ ਉਸ ਖੇਤਰ ਦੀ ਸਾਨੂੰ ਪੂਰੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਸੀਂ ਹਰ ਥਿਰੇ ਤੋਂ ਉਹ ਜਾਣਕਾਰੀ ਇਕੱਠੀ ਕਰਨ ਚਾਹੀਦੀ ਸਾਨੂੰ ਅਤੇ ਉਹ ਉਹ ਸਾਨੂੰ ਉਸ ਤੋਂ ਬਾਅਦ ਸਾਨੂੰ ਕਾਫੀ ਜ਼ਿਆਦਾ ਆਰਥਿਕ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਅਤੇ ਪਹਿਲਾਂ ਪਹਿਲਾਂ ਜਦੋਂ ਕਾਰੋਬਾਰ ਸਟਾਰਟ ਹੁੰਦਾ ਅਤੇ ਉਹਦੇ ਵਿੱਚ ਤੁਹਾਡੇ ਕੋਲੋਂ ਅਸੀਂ ਆਪਣਾ ਕੁਛ ਵੀ ਸਟਾਰਟ ਕਰਦੇ ਸਾਡੇ ਕੋਲ ਬਹੁਤ ਪੈਸੇ ਪੈਂਦੇ ਹਨ ਅਤੇ ਇਸ ਕਰਕੇ ਸਾਨੂੰ ਕਾਫੀ ਆਰਥਿਕ ਰਾਸ਼ੀ ਇਹ ਸਾਨੂੰ ਕਾਫੀ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਉਹ ਸਾਰੇ ਪੈ ਪੈਸੇ ਸਾਨੂੰ ਕਾਫੀ ਟਾਈਮ ਲਈ ਮਤਲਬ ਆਪਣੇ ਕੋਲੋਂ ਹੀ ਵਰਤਣੇ ਪੈਂਦੇ ਹਨ ਅਤੇ ਸਾਨੂੰ ਉੱਧਰੋਂ ਕਾਰੋਬਾਰ ਵਿੱਚੋਂ ਇੱਕਦਮ ਫਾਇਦਾ ਹੋਣਾ ਸਟਾਰਟ ਨਹੀਂ ਹੁੰਦਾ ਕਈ ਵਾਰੀ ਸਾਨੂੰ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਇਸ ਕਰਕੇ ਆਰਥਿਕ ਸਥਿਤੀ ਦਾ ਬੰਦੇ ਦੀ ਕਾਫੀ ਮਜ਼ਬੂਤ ਹੋਣੀ ਚਾਹੀਦੀ ਹੈ ਕਾਰੋਬਾਰ ਸਟਾਰਟ ਕਰਨ ਤੋਂ ਪਹਿਲਾਂ